ਦੇਖੋ ਜੀ ਸਾਡੀ ਤਾਂ ਰਵਾਇਤੀ ਖੇਡ ਕਬੱਡੀ ਓ ਹੈ ਜੀ ਜਿਵੇਂ ਕਿ ਪੰਜਾਬ ਦੇ ਹਰ ਇੱਕ ਪਿੰਡ ਅਤੇ ਕਸਬੇ ਵਿੱਚ ਕਬੱਡੀ ਖੇਲੀ ਜਾਂਦੀ ਹੈ ਇਹ ਬਹੁਤ ਹੀ ਵਧੀਆ ਗੇਮ ਹੈ ਜੀ ਜਿਸ ਨਾਲ਼ ਕਿ ਫਿੱਟਨੈਸ ਨੂੰ ਪ੍ਰੋਪਰ ਤਰੀਕੇ ਨਾਲ਼ ਬਰਕਰਾਰ ਰੱਖਿਆ ਜਾ ਸਕਦਾ ਹੈ ਇੱਕ ਤਾਂ ਜੀ ਇਹ ਬਹੁਤ ਹੀ ਵਧੀਆ ਆਊਟਡੋਰ ਗੇਮ ਹੈ ਇਸ ਨਾਲ਼ ਬੰਦਾ ਬਿਮਾਰੀਆਂ ਅਤੇ ਹੋਰ ਬਹੁਤ ਚੀਜ਼ਾਂ ਤੋਂ ਦੂਰ ਰਹਿੰਦਾ ਹੈ ਅਤੇ ਇੱਕ ਇਸ ਨਾਲ਼ ਬੰਦਾ ਆਪਣੀ ਫਿੱਟਨੈਸ ਨੂੰ ਮੈਨਟੇਨ ਕਰਦਾ ਹੈ ਅਤੇ ਨੰਬਰ ਦੋ ਇਸ ਨਾਲ਼ ਜ਼ੋਰ ਪ੍ਰਦਰਸ਼ਣ ਵੀ ਜ਼ਿਆਦਾ ਕਰਦਾ ਹੈ ਧੰਨਵਾਦ ਜੀ